ਹੈਲੋ ਹਾਂਜੀ ਹਾਂਜੀ ਸਾਡੇ ਕੋਲ ਕਾਫੀ ਸਾਰੇ ਫਰੂਟ ਨੇ ਜਿਵੇਂ ਕਿ ਸੇਬ ਕੇਲੇ ਅਨਾਰ ਪਪੀਤਾ ਸੀਤਾ ਫ਼ਲ ਹੋਰ ਵੀ ਬਹੁਤ ਸਾਰੇ ਨੇ ਤੁਸੀਂ ਦੱਸੋ ਕਿਹੜਾ ਲੈਣਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਫ਼ਲ ਅਸੀਂ ਖੁਦ ਮੰਗਵਾਉਂਦੇ ਹਾਂ ਜਿਹੜੇ ਸੇਬ ਆ ਉਹ ਕਸ਼ਮੀਰ ਤੋਂ ਲਿਆਂਦੇ ਆ ਅਤੇ ਜਿਹੜੇ ਬਾਕੀ ਫਰੂਟ ਆ ਉਹ ਸਾਰੇ ਆਪਾਂ ਸ਼ਹਿਰੋਂ ਜਾ ਕੇ ਖੁਦ ਲੈ ਕੇ ਆਉਦੇ ਹਾਂ ਬਹੁਤ ਵਧੀਆ ਨੇ ਤਾਜ਼ੇ ਨੇ ਅਤੇ ਬਹੁਤ ਵਧੀਆ ਹੈ ਤੁਸੀਂ ਦੱਸੋ ਕੇਲੇ ਸਾਡੇ ਸੱਠ ਰੁਪਈਏ ਦਰਜਨ ਸੇਬ ਡੇਢ ਸੌ ਜੀ ਤੁਹਾਨੂੰ ਸੌ ਲਾ ਦਾਂਗੇ ਕੇਲੇ ਸੱਠ ਆ ਅਤੇ ਤੁਹਾਨੂੰ ਪੰਜਾਹ ਲਾ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਆ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਤੁਹਾਡੀ ਪੈਕਿੰਗ ਤਿਆਰ ਹੋ ਜਾਊਗੀ ਤੁਸੀਂ ਲੈ ਜਿਓ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ

ਹਾਂਜੀ ਹਾਂਜੀ ਠੀਕ ਆ ਚਲੋ ਠੀਕ ਹੈ ਫਿਰ ਹਾਂਜੀ